ਮੈਂ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਹਾਂ ਮੇਰੇ ਸ਼ਹਿਰ ਵਿੱਚ ਬਹੁਤ ਸਾਰੇ ਆਰਟ ਐਂਡ ਕ੍ਰਾਫਟ ਦੇ ਮੇਲੇ ਲੱਗਦੇ ਹਨ ਮੇਰੇ ਸ਼ਹਿਰ ਵਿੱਚ ਬਹੁਤ ਸਾਰੇ ਆਰਟ ਐਂਡ ਕ੍ਰਾਫਟ ਦੀਆਂ ਸੰਸਥਾਵਾਂ ਹਨ ਜਿਵੇਂ ਕਿ ਆਰਟ ਕ੍ਰਾਫਟੀ ਵਿਰਸਾ ਬਹੁਤ ਹੀ ਇੱਕ ਚੰਗੀ ਸੰਸਥਾ ਹੈ ਇਹ ਆਰਟ ਐਂਡ ਕ੍ਰਾਫਟ ਨੂੰ ਬਹੁਤ ਉੱਚੇ ਪੱਧਰ 'ਤੇ ਲੈ ਕੇ ਗਈ ਹੈ ਮੇਰੇ ਸ਼ਹਿਰ ਵਿੱਚ ਬਹੁਤ ਸਾਰੇ ਚੰਗੇ ਕਲਾਕਾਰ ਹਨ ਜੋ ਕਿ ਬਹੁਤ ਚੰਗੀ ਕਲਾਕ੍ਰਿਤੀ ਬਣਾਉਂਦੇ ਹਨ ਅਤੇ ਬਹੁਤ ਜ਼ਿਆਦਾ ਸੋਹਣੀ ਕਲਾਕ੍ਰਿਤੀਆਂ ਬਣਾਉਂਦੇ ਹਨ ਇਹ ਕਲਾਕਾਰ ਨਾ ਇਹ ਕਲਾਕਾਰ ਵੀ ਕਰਾ ਆਰਟ ਐਂਡ ਕ੍ਰਾਫਟ ਵਿਰਸਾ ਵਿੱਚ ਭਾਗ ਲਿੱਤਾ ਸੀ ਮੈਨੇ ਇਹਨਾਂ ਨੂੰ ਪਹਿਲੀ ਵਾਰੀ ਆਰਟ ਐਂਡ ਕ੍ਰਾਫਟ ਵਿਰਸਾ ਵਿੱਚ ਵੇਖਿਆ ਸੀ ਇਹਨਾਂ ਨੇ ਬਹੁਤ ਚੰਗੀ ਅਚੰਗੇ ਚਿੱਤਰ ਬਣਾਏ ਸਨ ਜੋ ਕਿ ਬਹੁਤ ਹੀ ਚੰਗੇ ਦਿੱਖਦੇ ਸਨ ਮੇਰੇ ਘਰ ਦੇ ਵੀ ਮੇਰੇ ਨਾਲ ਇਹ ਆਰਟ ਐਂਡ ਕ੍ਰਾਫਟ ਮੇਲਾ ਵੇਖਣ ਗਏ ਸੀ ਉਹਨਾਂ ਨੂੰ ਇਹ ਮੇਲਾ ਬਹੁਤ ਹੀ ਚੰਗਾ ਲੱਗਿਆ ਉਹ ਇਹ ਮੇਲੇ ਨੂੰ ਵੇਖ ਕੇ ਬਹੁਤ ਹੀ ਖੁਸ਼ ਹੋਏ ਇੱਥੇ ਬਹੁਤ ਸਾਰੇ ਕਲਾਕਾਰ ਆਏ ਸਨ ਉਹਨਾਂ ਨੇ ਆਪਣੀ ਚਿੱਤਰਕਾਰੀ ਦਾ ਪ੍ਰਸਾਰ ਕੀਤਾ ਇਹ ਚਿੱਤਰਕਾਰੀ ਬਹੁਤ ਹੀ ਸੋਹਣੀ ਸਨ ਇੱਥੇ ਬਹੁਤ ਸਾਰੇ ਲੋਕ ਸਨ ਉਹ ਕਈ ਲੋਕ ਪੇਂਟਿੰਗ ਕਰ ਰਹੇ ਸੀ ਅਤੇ ਕਈ ਲੋਕ ਕੁਝ ਨਾ ਕੁਝ ਬਣਾ ਰਹੇ ਸੀ ਮੈਨੂੰ ਉਹ ਸਭ ਕੁਛ ਵੇਖ ਕੇ ਬੜਾ ਹੀ ਚੰਗਾ ਲੱਗਿਆ ਮੈਨੂੰ ਆਰਟ ਐਂਡ ਕ੍ਰਾਫਟ ਦਾ ਮੇਲਾ ਬਹੁਤ ਹੀ ਚੰਗਾ ਲੱਗਿਆ ਇਹ ਮੇਲਾ ਹਰ ਸਾਲ ਲੱਗਦਾ ਹੈ ਪਰ ਇਸ ਸਾਲ ਇਸ ਮੇਲੇ ਵਿੱਚ ਮੈਨੂੰ ਬਹੁਤ ਹੀ ਚੰਗਾ ਮਹਿਸੂਸ ਹੋਇਆ ਕਿਉਕਿ ਇਸ ਸਾਲ ਬਹੁਤ ਸ ਹੀ ਜ਼ਿਆਦਾ ਵੱਡੇ ਵੱਡੇ ਕਲਾਕਾਰ ਇਸ ਮੇਲੇ ਵਿੱਚ ਸ਼ਾਮਿਲ ਸਨ ਜੋ ਕਿ ਦੇਖ ਕੇ ਮੇਰੇ ਦਿਲ ਨੂੰ ਬੜਾ ਚੰਗਾ ਲੱਗਿਆ ਕਿ ਇਸ ਮੇਲੇ ਵਿੱਚ ਐਨੇ ਵੱਡੇ ਵੱਡੇ ਕਲਾਕਾਰ ਵੀ ਆਏ ਹੋਏ ਸਨ ਮੈਂ ਇਹਨਾਂ ਸਭ ਕਲਾਕਾਰਾਂ ਨੂੰ ਮਿਲੀ ਅਤੇ ਮੈਨੂੰ ਉਹਨਾਂ ਦੀ ਕਲਾਕ੍ਰਿਤੀ ਬਹੁਤ ਚੰਗੀ ਲੱਗੀ ਅਤੇ ਮੇਨੈ ਉਹਨਾਂ ਦੀ ਕਲਾਕ੍ਰਿਤੀ ਦੀ ਬਹੁਤ ਪ੍ਰਸੰਸਾ ਕੀਤੀ ਮੇਰੇ ਘਰਦਿਆਂ ਨੇ ਵੀ ਇਹ ਮੇਲਾ ਦੇਖਿਆ ਸੀ ਉਹਨਾਂ ਨੂੰ ਇਹ ਮੇਲਾ ਬੜਾ ਹੀ ਚੰਗਾ ਲੱਗਿਆ ਉਹ ਇਹ ਮੇਲੇ ਦੀ ਬਹੁਤ ਸਾਰੀ ਪ੍ਰਸ਼ੰਸਾ ਕਰ ਰਹੇ ਸਨ ਉਹ ਹਰ ਸਾਲ ਇਸ ਮੇਲੇ ਨੂੰ ਵੇਖਣ ਆਉਂਦੇ ਸੀ ਮੇਰਾ ਨਾਲ ਪਰ ਇਸ ਸਾਲ ਉਹਨਾਂ ਨੂੰ ਵੀ ਇਹ ਮੇਲਾ ਬਹੁਤ ਹੀ ਚੰਗਾ ਲੱਗਿਆ ਉਹਨਾਂ ਨੇ ਹੋਰ ਵੀ ਕਈ ਸੰਸਥਾਵਾਂ ਉੱਤੇ ਆਰਟ ਐਂਡ ਕ੍ਰਾਫਟ ਦਾ ਮੇਲਾ ਵੇਖਿਆ ਸੀ ਪਰ ਇਹ ਮੇਲਾ ਉਹਨਾਂ ਨੂੰ ਸਭ ਨਾਲੋਂ ਜ਼ਿਆਦਾ ਚੰਗਾ ਲੱਗਿਆ ਸੀ